ਸਿਮਰਨ ਦਾ ਨਾਮ ਸੁਣ ਕੇ ਅੱਜ ਕੱਲ੍ਹ ਹਰ ਕੋਈ ਇੱਦਾਂ ਸੋਚਦਾ ਹੈ ਕਿ ਇਹ ਤਾਂ ਪੁਰਾਣੇ ਲੋਕ ਕਰਦੇ ਸਨ ਬਜ਼ੁਰਗ ਹੋ ਜਾਂਦੇ ਹਨ ਬਜ਼ੁਰਗ ਲੋਕਾਂ ਨੂੰ ਆਪਣਾ ਬੁਢਾਪਾ ਬੁਢਾਪੇ ਦੇ ਵਿੱਚ ਰੱਬ ਦਾ ਸਿਮਰਨ ਕਰਨਾ ਚਾਹੀਦਾ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੈ ਪਰ ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਕੁਝ ਪੋਜੀਟਿਵਿਟੀ ਲਈ ਕੁਝ ਅੱਛੀ ਸੋਚ ਵਾਸਤੇ ਸਾਨੂੰ ਵੀ ਰੱਬ ਦਾ ਨਾਮ ਲੈਣਾ ਚਾਹੀਦਾ ਅਤੇ ਉਹਦੀ ਬਖਸ਼ੀ ਹੋਈ ਦਾਤ ਦੇ ਲਈ ਸਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਸਿਮਰਨ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਇਹ ਚੁਣੌਤੀਆਂ ਭਰੀਆ ਭਰੇ ਸਮੇਂ ਦੇ ਵਿੱਚ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਇਕਾਗਰ ਕਰਨ ਲਈ ਯੋਗਾ ਦੇ ਵਿੱਚ ਵੀ ਮਨ ਨੂੰ ਜਦੋਂ ਸ਼ਾਂਤ ਕਰਨਾ ਸਿਖਾਉਂਦੇ ਆ ਅਤੇ ਇਹ ਸਭ ਤੋਂ ਪਹਿਲਾਂ ਇਹੀ ਹੁੰਦਾ ਕਿ ਅਸੀਂ ਆਪਣੇ ਮਨ ਨੂੰ ਇਕਾਗਰ ਕਰੀਏ ਇਹ ਰੱਬ ਦਾ ਸਿਮਰਨ ਕਰੀਏ ਅਤੇ ਇਹਦੀ ਬਹੁਤ ਹੀ ਅਹਿਮੀਅਤ ਹੈ ਅੱਜ ਦੇ ਜੇ ਸਮੇਂ ਦੇ ਵਿੱਚ ਇਸ ਲਈ ਸਾਨੂੰ ਸਾਰਿਆਂ ਨੂੰ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਉਹਦੇ ਨਾਲ ਅਸੀਂ ਆਪਣੇ ਮਨ ਨੂੰ ਵੀ ਸ਼ਾਂਤ ਕਰ ਸਕਦੇ ਹਾਂ ਸਾਨੂੰ ਇੱਕ ਅੱਛੀ ਅਤੇ ਸੁਚੱਜੀ ਖੁਸ਼ੀ ਮਹਿਸੂਸ ਹੁੰਦੀ ਹੈ ਇਸ ਦੇ ਲਈ ਸ਼ੁਰੂ ਸ਼ੁਰੂ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਭਰੇ ਭਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਸਾ ਅਸੀਂ ਅੱਖਾਂ ਤਾਂ ਬੰਦ ਕਰ ਲੈਂਦੇ ਆ ਪਰ ਸਾਡਾ ਮਨ ਸ਼ਾਂਤ ਨਹੀਂ ਰਹਿ ਪਾਂਦਾ ਸਾਨੂੰ ਸੁਸਤੀ ਆਉਂਦੀ ਹੈ ਆਲਸ ਆਉਂਦਾ ਅਤੇ ਫਿਰ ਅਸੀਂ ਇਸ ਚੀਜ਼ ਤੋਂ ਭਟਕ ਜਾਂਦੇ ਹਾਂ ਅਤੇ ਬੰਦਾ ਨਿਰਾਸ਼ ਹੋ ਕੇ ਕਹਿੰਦਾ ਕਿ ਨਹੀਂ ਮੈਂ ਨਹੀਂ ਕਰ ਸਕਦਾ ਸਿਮਰਨ ਮੇਰੇ ਵੱਸ ਦਾ ਰੋਗ ਨਹੀਂ ਪਰ ਜਦੋਂ ਅਸੀਂ ਬੈਠਾਂਗੇ ਨਹੀਂ ਕੁਝ ਕਰਾਂਗੇ ਨਹੀਂ ਅਤੇ ਫਿਰ ਅਸੀਂ ਉਹ ਚੀਜ਼ ਦੇ ਸ਼ਿਖਰ ਤੱਕ ਕਿਵੇਂ ਪਹੁੰਚ ਸਕਦੇ ਹਾਂ ਇਸ ਲਈ ਸ਼ੁਰੂ ਦੇ ਵਿੱਚ ਸਾਨੂੰ ਇੱਕ ਮਿੰਟ ਲਈ ਅੱਧੇ ਮਿੰਟ ਲਈ ਅੱਖਾਂ ਬੰਦ ਕਰਕੇ ਇਕਾਂਤ ਦੇ ਵਿੱਚ ਆਪਣੇ ਮਨ ਨੂੰ ਸਿਰਫ ਆਪਣੇ ਉੱਪਰ ਹੀ ਸੋਚਣਾ ਚਾਹੀਦਾ ਆਪਣੇ ਮਨ ਨੂੰ ਸ਼ਾਂਤ ਕਰਨਾ ਚਾਹੀਦਾ ਹੌਲੀ ਹੌਲੀ ਕਰਕੇ ਅਸੀਂ ਬਹੁਤ ਲੰਬੇ ਟਾਈਮ ਤੱਕ ਬੈਠ ਸਕਦੇ ਹਾਂ ਫਿਰ ਰੱਬ ਦੇ ਨਾਲ ਆਪਣਾ ਮਨ ਲਗਾ ਸਕਦੇ ਹਾਂ ਜਿਹਦੇ ਨਾਲ ਇੱਕ ਅੱਛੀ ਪੋਜੀਟਿਵਿਟੀ ਸਾਡੇ ਹੱਥ ਲੱਗਦੀ ਹੈ ਧੰਨਵਾਦ